ਮੈਨੂੰ ਘੁੰਮਣਾ ਫਿਰਨਾ ਬਹੁਤ ਪਸੰਦ ਹੈ ਮੈਂ ਅੱਜ ਤੱਕ ਬਹੁਤ ਥਾਵਾਂ 'ਤੇ ਘੁੰਮ ਫਿਰ ਚੁੱਕੀ ਹਾਂ ਹੁਣ ਮੇਰਾ ਘੁੰਮਣ ਦਾ ਇਰਾਦਾ ਤਰਨ ਤਾਰਨ ਹੈ ਮੇਰੇ ਇਲਾਕਾ ਜੋ ਕਿ ਇੱਥੇ ਬਹੁਤ ਸਾਰੀਆਂ ਦੇਖਣ ਨੂੰ ਇਤਿਹਾਸਿਕ ਥਾਵਾਂ ਹਨ ਸਭ ਤੋਂ ਪਹਿਲਾਂ ਮੈਂ ਸ਼੍ਰੀ ਬਾਬਾ ਬੁੱਢਾ ਸਾਹਿਬ ਗਈ ਇੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਵਰ ਦਿੱਤਾ ਸੀ ਜੋ ਕਿ ਗੰਢੇ ਅਤੇ ਪ੍ਰਸ਼ਾਦੇ ਲੈ ਕੇ ਹੁਣ ਵੀ ਅੱਜ ਤੱਕ ਜੋ ਵੀ ਇੱਥੇ ਮਿੱਸੇ ਪ੍ਰਸ਼ਾਦੇ ਲੈ ਕੇ ਆਉਂਦੇ ਉਸ ਨੂੰ ਦੁੱਧ ਪੁੱਤ ਦੀ ਦਾਤ ਦੀ ਦਾਤ ਮਿਲਦੀ ਹੈ ਇਸ ਤੋਂ ਬਾਅਦ ਮੈਂ ਮਾਤਾ ਵੀਰੋ ਜੀ ਦੇ ਗੁਰਦੁਆਰੇ ਗਈ ਜਿੱਥੇ ਕਿ ਮਾਤਾ ਵੀਰੋ ਜੀ ਦਾ ਵਿਆਹ ਹੋਇਆ ਸੀ ਉੱਥੇ ਦਾ ਇਤਿਹਾਸ ਹੈ ਕਿ ਉੱਥੇ ਜੋ ਵੀ ਕੋਈ ਜਿਸਦਾ ਨਹੀਂ ਵਿਆਹ ਹੋ ਜਾਂਦਾ ਉਹ ਅਰਦਾਸ ਕਰਾਉਂਦਾ ਉਸ ਦਾ ਵਿਆਹ ਹੋ ਜਾਂਦਾ ਹੈ ਇਸ ਤੋਂ ਬਾਅਦ ਮੈਂ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਦੇ ਗੁਰਦੁਆਰੇ ਗਈ ਇੱਥੋਂ ਦਾ ਇੱਥੋਂ ਦਾ ਇਤਿਹਾਸ ਹੈ ਕਿ ਇੱਥੇ ਪਹਿਲਾਂ ਲੋਕ ਅੰਗਰੇਜ਼ ਲੋਕ ਕਰ ਲੈਂਦੇ ਸਨ ਅਤੇ ਉੱਥੇ ਬਾਬਾ ਗਰਜਾ ਸਿੰਘ ਦਾ ਅਤੇ ਬਾਬਾ ਬੋਤਾ ਸਿੰਘ ਜੀ ਇੱਥੇ ਸ਼ਹਾਦਤ ਹੋਈ ਉਸ ਤੋਂ ਬਾਅਦ ਝੂਲਣ ਮਹਿਲ ਇੱਥੇ ਇੱਕ ਕੰਧ ਹੈ ਜੋ ਕਿ ਅਰਦਾਸ ਕਰਕੇ ਬਾਬਾ ਜੀ ਉੱਥੇ ਬਿਠਾਉਣੇ ਹੋਣ ਉਹ ਹਾਥੀ ਦੀ ਤਰ੍ਹਾਂ ਝੂਲਦੀ ਹੈ ਅਤੇ ਇਹ ਜੁਗੋ ਜੁਗ ਅਟੱਲ ਰਹਿਣ ਵਾਲੀ ਕੰਧ ਹੈ ਇਸ ਤੋਂ ਬਾਅਦ ਤਰਨ ਤਾਰਨ ਸ਼੍ਰੀ ਦਰਬਾਰ ਸਾਹਿਬ ਗਈ ਉੱਥੇ ਮੈਨੂੰ ਜਾ ਕੇ ਬਹੁਤ ਹੀ ਆਨੰਦ ਆਇਆ ਮੈਂ ਕੀਰਤਨ ਸੁਣਿਆ ਉਸ ਤੋਂ ਬਾਅਦ ਮੈਂ ਲੰਗਰ ਛਕਿਆ ਅਤੇ ਇੱਥੋਂ ਦਾ ਇਤਿਹਾਸ ਇਹ ਹੈ ਕਿ ਇੱਥੇ ਗੁਰੂ ਅਰਜਨ ਦੇਵ ਜੀ ਸਾਹਿਬ ਪਾਤਸ਼ਾਹ ਨੇ ਕਿਹਾ ਸੀ ਜੋ ਵੀ ਇਥੇ ਕੋਹੜੀ ਆਊਗਾ ਉਸ ਦਾ ਦੁੱਖ ਦੂਰ ਹੋਊਗਾ ਧੰਨਵਾਦ